ਮੈਂ ਸਵਿਫਟ ਵੀ ਡੀ ਆਈ ਗੱਡੀ ਰੱਖੀ ਹੋਈ ਹੈ ਜਿਹੜੀ ਕਿ ਮੇਰੇ ਕੋਲ ਪਿਛਲੇ ਦਸ ਸਾਲਾਂ ਤੋਂ ਹੈ ਅਤੇ ਮੈਨੂੰ ਉਸ ਦੀ ਡਰਾਈਵਿੰਗ ਬੜੀ ਪਸੰਦ ਹੈ ਇਸ ਗੱਡੀ 'ਚ ਬੜੀ ਖਾਸੀਅਤ ਹੈ ਇੱਕ ਦਮ ਬਹੁਤ ਵਧੀਆ ਇੱਕ ਤਾਂ ਸਪੀਡ ਫੜਦੀ ਹੈ ਔਰ ਇਹਦੀ ਮਾਈਲੇਜ਼ ਬਹੁਤ ਵਧੀਆ ਹੈ ਮੈਂ ਇੱਕ ਇਹ ਆਪਣੇ ਯਾਰ ਦੋਸਤ ਹੈ ਸੋਨਾ ਸਿੰਘ ਲੁਧਿਆਣੇ ਤੋਂ ਹੈ ਉਹਦੇ ਕੋਲੋਂ ਖਰੀਦੀ ਸੀ ਅਤੇ ਮੈਂ ਇਹਦਾ ਦੂਸਰਾ ਖਰੀਦਦਾਰ ਹੈ ਮੈਨੂੰ ਇਸ ਗੱਡੀ ਦੇ ਵਿੱਚ ਮਤਲਬ ਇਹਦਾ ਏਅਰ ਕਨਡੀਸ਼ਨ ਵਗੈਰਾ ਦੀ ਬਹੁਤ ਹੀ ਵਧੀਆ ਉਹ ਲੱਗੀ ਹੈ ਇਹਦੀ ਪਿਕਅੱਪ ਬਹੁਤ ਵਧੀਆ ਹੈ ਮੈਨੂੰ ਘਰ ਦੇ ਮੈਂਬਰਾਂ ਦੇ ਨਾਲ ਜਾਣੇ ਆਉਣੇ ਨੂੰ ਬੜੀ ਸਹੂਲਤ ਹੈ ਇਹਦੀ ਸਰਦੀ ਹੈ ਗਰਮੀ ਹੈ ਬਰਸਾਤ ਹੈ ਬੜੀ ਸੁੱਖ ਆ ਇਹਦੀ ਗੱਡੀ ਦੀ ਆਪਾਂ ਕਈ ਵਾਰੀ ਆਪਣੇ ਰਿਸ਼ਤੇਦਾਰਾਂ 'ਚ ਜਾਈਦਾ ਅਤੇ ਗੱਡੀ ਲੈ ਕੇ ਬੜੀ ਟੌਹਰ ਬਣ ਜਾਂਦੀ ਹੈ ਇਸ ਗੱਡੀ ਨਾਲ ਅਤੇ ਇਸ ਗੱਡੀ 'ਚ ਬੈਟਰੀ ਵਗੈਰਾ ਦਾ ਵੀ ਬੜਾ ਬਹੁਤ ਹੈ ਵਧੀਆ ਲੱਗਿਆ ਮੈਨੂੰ ਇਹਦਾ ਹਿਸਾਬ ਕਿਤਾਬ ਅਤੇ ਐਵਰੇਜ ਵੀ ਬਹੁਤ ਵਧੀਆ ਹੈ ਇਹ ਗੱਡੀ ਤਾਂ ਮੈਂ ਤਾਂ ਬਹੁਤ ਏ ਮਨ ਖੁਸ਼ ਹੋ ਜਾਂਦਾ ਇਹ ਗੱਡੀ ਮੈਂ ਤਾਂ ਇਹ ਹੋਰ ਨੂੰ ਵੀ ਸਲਾਹ ਦਿੰਦਾ ਹੁੰਦਾ ਵੀ ਆਪਣਾ ਸਵਿਫਟ ਵੀ ਡੀ ਆਈ ਜਿਹੜੀ ਗੱਡੀ ਹੈ ਇਹਦੇ 'ਚ ਡਿੱਗੀ ਵਾਲਾ ਵੀ ਬਹੁਤ ਵਧੀਆ ਸਿਸਟਮ ਹੈ ਆਪਣਾ ਸਮਾਨ ਵੀ ਕੋਈ ਲਿਆਉਣਾ ਹੁੰਦਾ ਬਾਜ਼ਾਰੋ ਅਤੇ ਜੇ ਜਦ ਕਿਤੇ ਜਾਈਦਾ ਘੁੰਮਣ ਤਾਂ ਵੀ ਬੜੇ ਬੜੇ ਅਟੈਚੀ ਵੀ ਮਤਲਬ ਕਿ ਬੜੇ ਅਰਾਮ ਨਾਲ ਆ ਜਾਂਦੇ ਇਹਦੇ 'ਚ ਸਮਾਨ ਬਹੁਤ ਵਾਧੂ ਆ ਜਾਂਦਾ ਹੈ